ਮੇਰੀ ਮਨ ਪਸੰਦ ਲੇਖਿਕਾ ਹੈ ਅੰਮ੍ਰਿਤਾ ਪ੍ਰੀਤਮ ਕਿਉਂਕੀ ਉਹ ਬਹੁਤ ਵਧੀਆ ਲਿਖਦੇ ਨੇ ਉਹਨਾਂ ਦੀ ਲਿਖਤ ਮੈਨੂੰ ਬਹੁਤ ਪਸੰਦ ਹੈ ਉਹ ਜੋ ਵੀ ਕਹਾਣੀਆਂ ਲਿਖਦੇ ਨੇ ਜੋ ਵੀ ਨਾਵਲ ਲਿਖਦੇ ਨੇ ਜੋ ਵੀ ਉਹਨਾਂ ਨੇ ਕਵਿਤਾਵਾਂ ਨੇ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਕਿਉਂਕਿ ਜੋ ਉਹਨਾਂ ਦੀ ਕਵਿਤਾਵਾਂ ਹੈ ਉਹਨਾਂ ਵਿੱਚ ਬਿਰਹਾ ਉਹਨਾਂ ਵਿੱਚ ਆਨੰਦ ਉਹਨਾਂ ਵਿੱਚ ਜੋ ਸਕੂਨ ਹੈ ਉਹ ਹੋਰ ਕਿਸੇ 'ਚ ਨਹੀਂ ਹੈ ਮੈਨੂੰ ਉਹਨਾਂ ਦੀਆਂ ਕਿਤਾਬਾਂ ਪੜ੍ਹਨਾ ਬਹੁਤ ਜ਼ਿਆਦਾ ਪਸੰਦ ਹੈ ਅਤੇ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਹਨ ਜੋ ਉਨ੍ਹਾਂ ਦੀਆਂ ਕੁਝ ਲਿਖਤਾਂ ਹਨ ਉਹ ਹੈ ਅਤੇ ਰਸੀਦੀ ਟਿਕਟ ਅੱਜ ਆਖਾਂ ਵਾਰਿਸ ਸ਼ਾਹ ਨੂੰ ਪਿੰਜਰ ਮੇਰੀ ਪ੍ਰੇਅ ਕਹਾਣੀਆਂ ਤਿਰਕ ਬਾਵਨੋ ਕੀ ਗਾਥਾ ਅਤੇ ਹੋਰ ਸਾਰੀਆਂ ਜਿਵੇਂ ਕਿ ਗੋਂਚਲਾ ਹਿੰਦੀ 'ਚ ਵੀ ਨੇ ਪੰਜਾਬੀ 'ਚ ਵੀ ਨੇ ਖਮਾਸ਼ੀ ਖਾਮੋਸ਼ੀ ਤੋਂ ਪਹਿਲਾਂ ਸਤਾਰੋਂ ਕੀ ਗਲੀਆਂ ਇਹ ਸਾਰੀਆਂ ਅੰਮ੍ਰਿਤਾ ਪ੍ਰੀਤਮ ਦੀਆਂ ਨੇ ਮੈਂ ਤੈਨੂੰ ਫਿਰ ਮਿਲਾਂਗੀ ਇਹ ਬਹੁਤ ਸਾਰੀਆਂ ਇੱਦਾਂ ਦੀਆਂ ਕਿਤਾਬਾਂ ਨੇ ਜੋ ਮੈਂ ਪੜ੍ਹੀਆਂ ਨੇ ਇਹਨਾਂ 'ਚ ਬਹੁਤ ਸਾਰੀਆਂ ਕਿਤਾਬਾਂ ਤਾਂ ਕਵਿਤਾਵਾਂ ਨੇ ਸ਼ਾਇਰੀ ਹੈ ਕੁਝ ਕਹਾਣੀਆਂ ਨੇ ਕੁਝ ਨਾਵਲ ਨੇ ਮੈਨੂੰ ਬਹੁਤ ਵਧੀਆ ਲੱਗਦੀਆਂ ਨੇ ਅੱਜ ਫਿਰ ਆਖਾਂ ਵਾਰਿਸ ਸ਼ਾਹ ਨੂੰ ਬਹੁਤ ਵਧੀਆ ਕਿਤਾਬ ਹੈ ਉਹਦੇ 'ਚ ਇੱਕ ਬਿਰਹਾ ਹੈ ਕਿਵੇਂ ਇੱਕ ਹੀਰ ਕਿੱਦਾਂ ਬਿਆਨ ਕੀਤੀ ਹੋਈ ਹੈ ਕਿ ਉਹ ਫਿਰ ਪੰਜਾਬ ਨੂੰ ਕਹਿ ਉਹਨੇ ਉਹਦੇ 'ਚ ਇੱਕ ਪੰਜਾਬ ਬਿਆਨ ਕੀਤਾ ਹੋਇਆ ਕਿ ਉੱਨੀ ਸੌ ਸੰਤਾਲੀ ਤੋਂ ਪਹਿਲਾਂ ਦਾ ਪੰਜਾਬ ਕੀ ਸੀ ਉੱਨੀ ਸੌ ਸੰਨਤਾਲੀ ਦਾ ਬਾਅਦ ਦਾ ਪੰਜਾਬ ਕੀ ਹੈ ਮੈਨੂੰ ਇਹਨਾਂ ਦੀ ਲਿਖਤਾਂ ਬਹੁਤ ਪਸੰਦ ਹੈ ਅਤੇ ਜੇ ਇੱਕ ਵਿਅਕਤੀ ਜੋ ਲੇਖਕ ਹੁੰਦਾ ਏ ਉਹਦੇ 'ਚ ਇਕ ਕਲਾ ਹੁੰਦੀ ਲਿਖਣ ਦੀ ਉਹਦਾ ਜੋ ਹੁਨਰ ਹੈ ਉਹਦੀ ਜੋ ਲਿਖਣ ਦੀ ਇਮੈਜੀਨੇਸ਼ਨ ਹੈ ਉਹ ਬਹੁਤ ਵਧੀਆ ਲੱਗਦੀ ਮੈਨੂੰ ਅਤੇ ਇਹਦੇ 'ਚ ਹਰ ਇੱਕ ਬੰਦੇ 'ਚ ਗੁਣ ਹੋਣੇ ਚਾਹੀਦੇ ਨੇ ਇੱਕ ਲਿਖਣ ਦਾ ਗੁਣ ਬਹੁਤ ਵਧੀਆ ਗੁਣ ਹੈ ਉਹਦੇ 'ਚ ਉਹਨੂੰ ਇੱਕ ਡਿਸਿਪਲਨ ਹੋਵੇ ਇੱਕ ਉਹਦੇ 'ਚ ਚੀਜ਼ ਨੂੰ ਬਿਆਨ ਕਰਨ ਦਾ ਤਰੀਕਾ ਹੋਵੇ ਬਿਰਹਾ ਹੋਵੇ ਸਕੂਨ ਹੋਵੇ ਆਨੰਦ ਹੋਵੇ ਇਹ ਇੱਕ ਲੇਖਕ ਦੇ ਬਾਰੇ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ